ਹੈਲੋ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬੋਲੋ ਜੀ ਬੋਲੋ ਹਾਂਜੀ ਆ ਜੀ ਮਕਸਦ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਅਨੰਦਪੁਰ ਤੋਂ ਲੜਦੇ ਲੜਦੇ ਚਮਕੌਰ ਸਾਹਿਬ ਦੀ ਗੜੀ 'ਚ ਆਏ ਅਤੇ ਚਮੋ ਚਮਕੌਰ ਦੀ ਗੜੀ 'ਚ ਆਏ ਉਹਨਾਂ ਦੇ ਆਪਣੇ ਬੱਚੇ ਸ਼ਹੀਦ ਹੋ ਗਏ ਉੱਥੇ ਮਾਛੀਵਾੜੇ ਵਿੱਚ ਆਏ ਮਾਛੀਵਾੜੇ ਤੋਂ ਫਿਰ ਇੱਧਰ ਖਿਦਰਾਣੇ ਦੀ ਢਾਬ ਟਿੱਬ ਟਿੱਬੀ ਸਾਹਿਬ ਆ ਕੇ ਆਏ ਟਿੱਬੀ ਸਾਹਿਬ ਆਏ ਉਥੋਂ ਫਿਰ ਸਿੰਘਾਂ ਨੇ ਤੰਬੂ ਸਾਹਿਬ ਗੁਰਦੁਆਰੇ ਕਸ਼ਹਿਰੇ ਪਾ ਕੇ ਲੜਦੇ ਲੜਦੇ ਉਹ ਚਾਲ੍ਹੀ ਸਿੰਘ ਸ਼ਹੀਦ ਹੋ ਗਏ ਸ਼ਹੀਦ ਕਰ ਗੁਰਦਵਾਰਾ ਗੁਰੂ ਗੁਰੂ ਸਾਹਿਬ ਆਪਣੇ ਖਿਦਰਾਣੇ ਮੁਕ ਆਪਣੇ ਮੁਕਤਸਰ ਖਿਦਰਾਣੇ ਦੀ ਢਾਬ 'ਤੇ ਬੈਠੇ ਲੜਾਈ ਕਰ ਰਹੇ ਸੀ ਉਥੋਂ ਤੀਰ ਛੱਡਦੇ ਤੀਰ ਛੱਡਦੇ ਬਾਅਦ 'ਚ ਉੱਥੇ ਗੁਰੂ ਸਾਹਿਬ ਨੇ ਘੋੜਾ ਬੰਨਿਆ ਟਿੱਬੀ ਸਾਹਿਬ ਗੁਰਦੁਆਰੇ ਲੜਾਈ ਕਰਦੇ ਕਰਦੇ ਮੁੜ ਮੁੜ ਕੇ ਇੱਥੇ ਚਾਲ੍ਹੀ ਸਿੰਘਾਂ ਦਾ ਆ ਕੇ ਗੁਰੂ ਸਾਹਿਬ ਨੇ ਸਸਕਾਰ ਕੀਤਾ ਅਤੇ ਉਹਨਾਂ ਨੇ ਆਖਿਆ ਵੀ ਤੁਸੀਂ ਜਿਹੜਾ ਬੇਦਾਵਾ ਮੇਰੇ ਨਾਲ ਝੂਠੇ ਉਹ ਕੀਤੇ ਸੀ ਤੁਸੀਂ ਇਹਨੂੰ ਪਾੜ ਦਿਓ ਗੁਰੂ ਸਾਹਿਬ ਨੇ ਉਹ ਬੇਦਾਵਾ ਪਾੜਿਆ ਉੱਥੇ ਵਣ ਦੇ ਨਾਲ ਘੋੜਾ ਬੰਨਿਆ ਖਿਦਰਾਣੇ ਦੀ ਢਾਬ ਨਾਲ ਠੀਕ ਆ ਜੀ ਮੁੜ ਕੇ ਬਾਅਦ 'ਚ ਉੱਥੇ ਜਾਣੀ ਮੁਸਲਮਾਨ ਸੀਗਾ ਉਹਨੇ ਆ ਕੇ ਗੁਰੂ ਸਾਹਿਬ ਦੇ ਮਗਰ ਦੀ ਵਾਰ ਕਰ ਦਿੱਤਾ ਗੁਰੂ ਸਾਹਿਬ ਨੇ ਉੱਥੇ ਉਹਨਾਂ ਦੇ ਪਿੱਛੇ ਦੀ ਹੋ ਕੇ ਗੜਵਾ ਮਾਰਿਆ ਕਿਉਂਕਿ ਹੁਣ ਸਿੰਘ ਜਦੋਂ ਘੋੜ ਸਵਾਰੀ ਕਰਦੇ ਆ ਜਾ ਕੇ ਉੱਥੇ ਉਹਨਾਂ ਉਹਨਾਂ ਦੇ ਸਿਰ ਦੇ ਵਿੱਚ ਜੁੱਤੀਆਂ ਕਬਰ 'ਤੇ ਜੁੱਤੀਆਂ ਮਾਰਦੇ ਆ ਹਾਂ ਹੋਰ ਕੋਈ ਗੱਲ ਪੁੱਛਣੀ ਕਾਕਾ ਜੀ ਪੁੱਛ ਲਓ ਕੋਈ ਹੋਰ ਇਤਿਹਾਸ ਬਾਰੇ ਉਹਨਾ ਨਾਲ ਉਹਨਾਂ ਨਾਲ ਉਹਨਾਂ 'ਤੇ ਜੀ ਉਹਨਾਂ ਦਾ ਕੋਈ ਮਹਾਰਾਜ ਦਾ ਹੁਕਮ ਸੀਗਾ ਵੀ ਇਹਨਾਂ ਨਾਲ ਮੁਗਲਾਂ ਨਾਲ ਲੜਦੇ ਲੜਦੇ ਉਹਨੇ ਆ ਕੇ ਵਾਰ ਕਰ ਦਿੱਤਾ ਅਤੇ ਉਹਨਾਂ ਨੇ ਫਿਰ ਉਹਨੂੰ ਸ਼ਰਾਫ ਦਿੱਤਾ ਉਹਦੇ ਇੱਕ ਗੜਵੇ ਨਾਲ ਹੀ ਉਹਨਾਂ ਦੇ ਮੌਤ ਹੋ ਗਈ ਅਤੇ ਹੁਣ ਆਪਣੇ ਸਿੱਖ ਹੈ ਨਾ ਜਿਹੜੇ ਇਹ ਇਹਨਾਂ ਇਹਨਾਂ ਨੂੰ ਮੁਸਲਮਾਨਾਂ ਨੂੰ ਨਫ਼ਰਤ ਕਰਦੇ ਆ ਫਿਰ ਇਹਨਾਂ ਦੇ ਵੀ ਉੱਥੇ ਜਾ ਕੇ ਨਾ ਘੋੜ ਸਵਾਰੀ ਜਦੋਂ ਮੇਲਾ ਲੱਗਦਾ ਹੈ ਉਦੋਂ ਉਦੋਂ ਜਾ ਕੇ ਨਾ ਉਹ ਛਿੱਤਰ ਮਾਰਦੇ ਆ ਘੋੜ ਸਵਾਰੀ ਹੁੰਦੀ ਹਾਂਜੀ ਅਤੇ ਹਾਂ ਤੁਹਾਨੂੰ ਵੀ ਕੋਈ ਇਸ ਗੱਲ ਬਾਰੇ ਗੁਰੂ ਸਾਹਿਬ ਬਾਰੇ ਕੁਝ ਪਤਾ ਹੈ ਠੀਕ ਹੈ ਠੀਕ ਹੈ ਹਾਂ ਫਿਰ ਤੁਸੀਂ ਠੀਕ ਹੈ ਜੀ ਸ਼ੁਕਰੀਆ